ਪੰਜਾਬ ਦੀ ਵੰਡ ਬਹੁਤ ਵਾਰ ਹੋ ਚੁੱਕੀ ਹੈ ਪਹਿਲਾਂ ਉੱਨੀ ਸੌ ਸੰਤਾਲੀ ਫੇਰ ਉੱਨੀ ਸੌ ਛਿਆਹਠ ਵਿੱਚ ਅਤੇ ਇਸ ਤੋਂ ਇਲਾਵਾ ਪੰਜਾਬ ਨੂੰ ਭਾਸ਼ਾ ਦੇ ਖੇਤਰ 'ਤੇ ਵੀ ਵੰਡਿਆ ਗਿਆ ਹੈ ਇਸ ਵਿੱਚ ਆਰਥਿਕ ਪ੍ਰਭਾਵ ਬਹੁਤ ਜ਼ਿਆਦਾ ਹੋਏ ਸਨ ਜਿਸ ਵਿੱਚ ਲੋਕਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਸੀ ਉਨ੍ਹਾਂ ਦੇ ਕੋਲ ਰਹਿਣ ਸਹਿਣ ਲਈ ਜਗ੍ਹਾ ਦੀ ਕਮੀ ਸੀ ਆਰਥਿਕ ਜਿੱਥੇ ਖੇਤੀ ਕਰਨ ਯੋਗ ਵੀ ਖੇਤ ਬਹੁਤ ਘੱਟ ਸਨ ਇਸ ਤੋਂ ਇਲਾਵਾ ਫਿਰ ਜਦੋਂ ਹੁਣ ਨਵੀਆਂ ਸਰਕਾਰਾਂ ਅਤੇ ਆਪਾਂ ਕਹਿ ਸਕਦੇ ਹਾਂ ਅਗਲੇ ਦਹਾਕਿਆਂ ਵਿੱਚ ਇਸ ਖੇਤਰ ਨੇ ਕਾਫ਼ੀ ਸੁਧਾਰ ਕੀਤੇ ਹਨ ਸਰਕਾਰਾਂ ਨੇ ਗਰੀਬ ਲੋਕਾਂ ਲਈ ਬਹੁਤ ਸਾਰੇ ਫੈਸਲੇ ਕੀਤੇ ਹਨ ਉਨ੍ਹਾਂ ਨੂੰ ਰਹਿਣ ਲਈ ਖੇ ਜ਼ਮੀਨ ਅਤੇ ਖਾਣ ਲਈ ਜਿੱਦਾਂ ਕਹਿ ਸਕਦੇ ਹਾਂ ਰਾਸ਼ਨ ਆਦਿ ਦੀ ਸਹੂਲਤ ਦਿੱਤੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੁੜ ਵਸਨੀਕ ਲਈ ਉਨ੍ਹਾਂ ਦੀ ਬਹੁਤ ਸਾਰੀ ਮਦਦ ਕੀਤੀ ਹੈ